ਤੀਹ ਜਨਵਰੀ ਉੱਨੀ ਸੌ ਸਤਾਨਵੇਂ ਉੱਨੀ ਮਾਰਚ ਦੋ ਹਜ਼ਾਰ ਛੇ ਪੱਚੀ ਫਰਵਰੀ ਦੋ ਹਜ਼ਾਰ ਨੌਂ ਤੀਹ ਨਵੰਬਰ ਦੋ ਹਜ਼ਾਰ ਅਠਾਰਾਂ